ਪੰਜਾਬ ਵਿੱਚ ਕਾਰੋਬਾਰੀ ਮਾਹੌਲ ਉਦਮ ਦਾ ਵਿਕਦਾ ਸਮਰਥਨ ਬਹੁਤ ਤਰੀਕੇ ਨਾਲ ਕਰਦਾ ਹੈ ਜਿਵੇਂ ਕਿ ਪੁਰਾਤਨ ਤਰੀਕੇ ਅਸੀਂ ਦੇਖਿਆ ਕਰਦੇ ਸੀ ਬਹੁਤ ਜ਼ਿਆਦਾ ਕੰਮ ਕਰਨੇ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਬਹੁਤ ਵੱਧ ਮੁਸ਼ਕਿਲਾਂ ਆਉਂਦੀਆਂ ਸੀ ਇੱਕ ਬੰਦੇ ਕੰਮ ਕਰਨ ਲਈ ਲੇਬਰ ਬਹੁਤ ਜ਼ਿਆਦਾ ਲੱਗਦੀ ਸੀ ਹੱਥ ਬਹੁਤ ਜ਼ਿਆਦਾ ਚਾਹੀਦੇ ਸੀ ਇੱਕ ਕੰਮ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਬਹੁਤ ਜ਼ਿਆਦਾ ਖਰਚਾ ਹੁੰਦਾ ਸੀ ਅਤੇ ਮਾਲਕ ਨੂੰ ਮੁਨਾਫਾ ਘੱਟ ਹੁੰਦਾ ਸੀ ਅਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਜਿਸ ਕਰਕੇ ਹੁਣ ਨਵਾਂ ਹੁਣ ਪੁਰਾਣੇ ਤਰੀਕੇ ਦੇ ਨਾਲ ਕੰਮ ਬੰਦ ਹੋਣ ਕਰਕੇ ਨਵੀਨੀਕਰਨ ਦੇ ਨਾਲ ਕੰਮ ਸ਼ੁਰੂ ਹੋਇਆ ਹੈ ਨਵੀਨੀਕਰਨ ਦੇ ਕੰਮ ਕਰਨ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜਿਸ ਵਿੱਚ ਲੇਖ ਨਵੀਆਂ ਮਸ਼ੀਨਾਂ ਲੱਗ ਗਈਆਂ ਹਨ ਜੋ ਕਿ ਸਮੇਂ ਸਮੇਂ ਅਤੇ ਟਾਈਮ ਦੀ ਬਚਤ ਕਰਦੀਆਂ ਹਨ ਅਤੇ ਕੰਮ ਨੂੰ ਜਿਸ ਨੇ ਬਹੁਤ ਸੌਖਾ ਕਰ ਦਿੱਤਾ ਹੈ ਅੱਜ ਕੱਲ੍ਹ ਦੇ ਕੰਮ ਦੇ ਨਵੀਆਂ ਤਕਨੀਕਾਂ ਆ ਗਈਆਂ ਹਨ ਜਿਹੜਾ ਸਮਾਂ ਬਹੁਤ ਬਚਾਂਦੀਆਂ ਹਨ ਸੌ ਬੰਦਿਆਂ ਦਾ ਕੰਮ ਦਸ ਬੰਦੇ ਕਰ ਰਹੇ ਹਨ ਇਸ ਤਰੀਕੇ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਲੇਬਰ ਘੱਟ ਲੱਗ ਰਹੀ ਹੈ ਅਤੇ ਖਰਚਾ ਘਟਿਆ ਹੈ ਜਿਸ ਕਰਕੇ ਮਾਲਕਾਂ ਦਾ ਮੁਨਾਫਾ ਵਧਿਆ ਹੈ ਚੀਜ਼ਾਂ ਦੇ ਦਾਮ ਵੱਧ ਗਏ ਹਨ ਦਾ ਚੀਜ਼ਾਂ ਨੂੰ ਸਪਲਾਈ ਕਰਨ ਲਈ ਟਰਾਂਸਪੋਰਟ ਦਾ ਖਰਚਾ ਬਹੁਤ ਘੱਟ ਗਿਆ ਹੈ ਸੜਕਾਂ ਦੇ ਬਣਨ ਕਰਕੇ ਟਰਾਂਸਪੋਰਟ ਦੀ ਆਵਾਜਾਈ ਬਹੁਤ ਜਲਦੀ ਹੋ ਗਈ ਹੈ ਜਿਸ ਨਾਲ ਟ੍ਰਾਂਪੋਰਟਰਾਂ ਨੂੰ ਵੀ ਬਹੁਤ ਫਾਇਦਾ ਹੋਇਆ ਹੈ ਬਿਜਨਸ ਦੇ ਤਰੀਕੇ ਸਮੇਂ ਸਮੇਂ 'ਤੇ ਬਦਲਦੇ ਹੀ ਰਹਿੰਦੇ ਹਨ ਅੱਜ ਦੇ ਯੁੱਗ ਦੇ ਵਿੱਚ ਪਹਿਲੇ ਯੁਗ ਦੇ ਵਿੱਚ ਹਰ ਇੱਕ ਕੰਮ ਨੂੰ ਹੱਥ ਨਾਲ ਕੀਤਾ ਜਾਂਦਾ ਸੀ ਜਿਸ ਵਿੱਚ ਅਸੀਂ ਦੇਖਦੇ ਹੁੰਦੇ ਸੀ ਕੋਈ ਅਕਾਊਂਟਸ ਦਾ ਕੰਮ ਵੀ ਕਰਦੇ ਸੀ ਤਾਂ ਹੱਥ ਨਾਲ ਸਾਰਾ ਸੰਭਾਲਦੇ ਸੀ ਸਾਰੇ ਵਹੀ ਖਾਤੇ ਹੱਥ ਨਾਲ ਲਿਖੇ ਜਾਂਦੇ ਸੀ ਅਤੇ ਪੂਰੀ ਦੀ ਪੂਰੀ ਲੈਜਰ ਬੈਲੈਂਸ ਸ਼ੀਟ ਅਕਾਊਂਟ ਸਟੇਟਮੈਂਟ ਕਿੰਨੇ ਕਿਹਦੇ ਕੋਲ ਕਿੰਨੇ ਮਾਲ ਆਇਆ ਕਿਹਦੇ ਕੋਲ ਕਿੰਨਾ ਮਾਲ ਗਿਆ ਕਿਹਦਾ ਬਿੱਲ ਚਾੜ੍ਹਨਾ ਸਾਰਾ ਚੀਜ਼ ਹੱਥ ਨਾਲ ਲਿਖਣ ਕਰਕੇ ਟਾਈਮ ਵੀ ਬਹੁਤ ਸ਼ ਵੇਸਟ ਹੁੰਦਾ ਸੀ ਜੋ ਅੱਜ ਇੱਕ ਸੀ ਨਵੀਂ ਟੈਲੀ ਸੋਫਟਵੇਅਰ ਨੇ ਸਾਰੀ ਜਗ੍ਹਾ ਲੈ ਲਈ ਹੈ ਟੈਲੀ ਸੋਫਟਵੇਅਰ ਦੇ ਵਿੱਚ ਕੋਈ ਵੀ ਬਿੱਲ ਆਉਂਦਾ ਹੈ ਤਾਂ ਦੁਕਾਨਦਾਰ ਉਸ ਨੂੰ ਮਿੰਟ ਤੋਂ ਪਹਿਲਾਂ ਕੰਪਿਊਟਰ 'ਤੇ ਚੜ੍ਹਾ ਦਿੰਦਾ ਹੈ ਜਿਸ ਦਾ ਬਿੱਲ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਸ ਦੁਕਾਨਦਾਰ ਤੋਂ ਕਿੰਨਾ ਮਾਲ ਲਿਆਂਦਾ ਉਹਦਾ ਕਿੰਨਾ ਉਹਦਾ ਕਿੰਨਾ ਭੁਗਤਾਨ ਦੇ ਦਿੱਤਾ ਉਹਦਾ ਕਿੰਨਾ ਸਾਡੇ ਕੋਲ ਬੈਲੈਂਸ ਰਹਿ ਗਿਆ ਸੋ ਸਮੇਂ ਸਮੇਂ ਦੇ ਹਿਸਾਬ ਨਾਲ ਬਹੁਤ ਕੁਛ ਬਦਲਿਆ ਹੈ ਬਿਜਨਸ ਕਰਨ ਦੇ ਤਰੀਕੇ ਬਦਲ ਗਏ ਹਨ ਜਿਸ ਕਰਕੇ ਲੋਕਾਂ ਨੇ ਸੋਚ ਵੀ ਬਹੁਤ ਵੱਡੀ ਹੋ ਗਈ ਹੈ ਸੋਚ ਵੱਡੀ ਹੋਣ ਕਰਕੇ ਬਿਜ਼ਨਸ ਦੇ ਮੁਨਾਫੇ ਵੀ ਬਹੁਤ ਵਧੇ ਹਨ ਪੁਰਾਣੀਆਂ ਚੀਜ਼ਾਂ ਰਿਪਲੇਸਮੈਂਟ ਹੋ ਕੇ ਨਵੀਆਂ ਚੀਜ਼ਾਂ ਨੇ ਕਵਰ ਅਪ ਕਰ ਲਿਆ ਹੈ